ਹੈਲੋ ਹਾਂਜੀ ਨਮਸਕਾਰ ਮੈਡਮ ਤੁਸੀਂ ਦੱਸੋ ਮੈਡਮ ਮੈਂ ਤਾਂ ਆਪ ਮੈਡਮ ਤੁਹਾਨੂੰ ਪੁੱਛਣਾ ਸੀਗਾ ਬਸ ਸਕੂਲ 'ਚ ਟਾਈਮ ਜਿਹਾ ਹੀ ਨਹੀਂ ਲੱਗਿਆ ਹੈਗਾ ਮੈਂ ਵੀ ਕਰਨਾ ਸੀ ਤੁਹਾਨੂੰ ਫੋਨ ਮੈਂਖਾ ਏਕਤਾ ਮੈਡਮ ਤੋਂ ਪੁੱਛਾਂਗੇ ਕਿਵੇਂ ਕਰੀਏ ਬਾਕੀ ਤੁਸੀਂ ਸੀਨੀਅਰ ਹੋ ਤੁਸੀਂ ਦੇਵੋ ਰਾਏ ਕਿਵੇਂ ਕਰੀਏ ਆਪਾਂ ਹਾਂਜੀ ਬਿਲਕੁਲ ਮੈਡਮ ਸੁਜੈਸ਼ਨ ਤਾਂ ਆਂਏਂ ਹੈ ਦੇਖੋ ਹੁਣ ਆਪਾਂ ਹੁਣ ਆਪਾਂ ਆਂਏਂ ਵੀ ਬੱਚਿਆਂ ਦੀਆਂ ਆਪਣੇ ਵਾਲਿਆਂ ਦੀਆਂ ਆਪਾਂ ਔਨਲਾਈਨ ਕਲਾਸਸ ਵਗੈਰਾ ਕਰ ਸਕਦੇ ਹਾਂ ਜੇ ਇਨ੍ਹਾਂ ਨੂੰ ਅ ਰੂਟੀਨ ਤੋਂ ਵੱਧ ਕੋਈ ਆਪਾਂ ਹੋਮਵਰਕ ਜਾਂ ਕੁਛ ਦਿੰਦੇ ਇਨ੍ਹਾਂ ਨੇ ਉਹ ਨਹੀਂ ਕਰਨਾ ਹੈਗਾ ਫਿਰ ਆਪਾਂ ਕਿਵੇਂ ਸਿਲੇਬਸ ਇਨ੍ਹਾਂ ਦਾ ਕੰਪਲੀਟ ਕਰਾਈਏ ਬਾਕੀ ਹੁਣ ਇਹ ਬਾਰਿਸ਼ ਹੈ ਪਹਿਲੇ ਪੰਦਰ੍ਹਾਂ ਦਿਨ ਹੋਰ ਨਹੀਂ ਪਤਾ ਕਿਵੇਂ ਰਹੇਗਾ ਮੌਸਮ ਹੈ ਨਾ ਤੁਸੀਂ ਦੇਵੋ ਰਾਏ ਆਪਾਂ ਉਵੇਂ ਕਰ ਲਵਾਂਗੇ ਜਿਵੇਂ ਆਪਾਂ ਸਿਲੇਬਸ ਦਾ ਕਵਰ ਕਰਾਵਾਂਗੇ ਕਿਉਂਕਿ ਬੱਚਿਆਂ ਦੇ ਪੇਪਰ ਲੈਣੇ ਹੈ ਫੇਰ ਆਪਾਂ ਅੱਗੇ ਰਿਵੀਜਨ ਕਰਵਾਉਣੀ ਹੈ ਇਨ੍ਹਾਂ ਨੂੰ ਜੇ ਸਿਲੇਬਸ ਕੰਪਲੀਟ ਹੋਊਗਾ ਤਾਂ ਹੀ ਇਨ੍ਹਾਂ ਨੂੰ ਆਪਾਂ ਰਿਵੀਜਨ ਕਰਾਵਾਵਾਂਗੇ ਫਿਰ ਹਾਂਜੀ ਬਿਲਕੁਲ ਬਿਲਕੁਲ ਮੈਨੂੰ ਆਂਏ ਲੱਗਦਾ ਮੈਡਮ ਉਹ ਵੀ ਆਪਣੀ ਜ਼ਿੰਮੇਵਾਰੀ ਹੋਊਗੀ ਕਿਉਂਕਿ ਆਪਣੇ ਬੱਚਿਆਂ ਦੇ ਪੇਰੈਂਟਸ ਨੇ ਤਾਂ ਕੁਛ ਨਹੀਂ ਕਰਵਾਉਣਾ ਜਿਹੜੇ ਆਪਣੇ ਮਤਲਬ ਪੰਜ ਚਾਰ ਬੱਚੇ ਨੇ ਮੂਹਰਲੇ ਉਹ ਤਾਂ ਕਰ ਲਿਆ ਕਰਨਗੇ ਬਾਕੀ ਬੱਚੇ ਫੇਰ ਪਿੱਛੇ ਰਹਿ ਜਾਣਗੇ ਬਸ ਮੈਂ ਤਾਂ ਉਹੀ ਮਤਲਬ ਐਂਈਂ ਕਹਿੰਦੇ ਸੀਗੇ ਵੀ ਜਿ ਜਿਵੇਂ ਸਕੂਲ 'ਚੋਂ ਹੀ ਜਾ ਕੇ ਚਾਹੇ ਆਪਾਂ ਨੂੰ ਚਾਹੇ ਫੋਨ ਕਰਕੇ ਇਕੱਲੇ ਇਕੱਲੇ ਪੇਰੈਂਟਸ ਨੂੰ ਕਿਹਾ ਜਾਵੇ ਆਪਾਂ ਵੀ ਪੁਹੰਚਦੇ ਹਾਂ ਵੀ ਹਾਂ ਆਪਾਂ ਵੀ ਪਹੁੰਚਦੇ ਹਾਂ ਵੀ ਬੱਚਿਆਂ ਨੂੰ ਔਖੇ ਸੌਖੇ ਸਕੂਲ 'ਚ ਤੁਸੀਂ ਭੇਜੋ ਕਿਉਂਕਿ ਦੇਖੋ ਆਪਾਂ ਵੀ ਐਨਾ ਧਿਆਨ ਰੱਖਦੇ ਹਾਂ ਜਦੋਂ ਬਾਰਿਸ਼ ਦਾ ਮੌਸਮ ਹੁੰਦਾ ਹੈ ਜਾਂ ਹਲਕੀ ਹੁੰਦਾ ਆਪਾਂ ਬੱਚਿਆਂ ਨੂੰ ਪਹਿਲਾਂ ਹੀ ਭੇਜਣ ਲੱਗ ਜਾਂਦੇ ਹਾਂ ਹੈ ਨਾ ਵੀ ਤੁਸੀਂ ਵੀ ਭਾਈ ਜ਼ਿੰਮੇਵਾਰੀ ਸਮਝ ਕੇ ਭੇਜੋ ਅਸੀਂ ਸਿਲੇਬਸ ਕਰਵਾਉਣਾ ਅੱਛਾ ਫਿਰ ਉਹੀ ਚੱਕਰ ਮੈਡਮ ਜਿਵੇਂ ਤੁਸੀਂ ਕਹਿੰਦੇ ਹੋ ਆਪਾਂ ਫੋਨ 'ਤੇ ਪਾ ਦਿਆ ਕਰਾਂਗੇ ਕੁਛ ਕੁ ਕੋਲ ਜਾਇਆ ਕਰੂ ਕੁਛ ਕੁ ਕੋਲ ਪਹੁੰਚਿਆ ਨਹੀਂ ਕਰਨਾ ਹਾਂ ਕੁਛ ਕੁ ਕਰਿਆ ਕਰਨਗੇ ਕਿਸੇ ਨੇ ਕਰਨਾ ਨਹੀਂ ਉਹ ਫਿਰ ਆਪਣੀ ਦੁਬਾਰ ਤੋਂ ਫਿਰ ਆਪਾਂ ਨੂੰ ਹੀ ਆਊਗਾ ਬ ਬੱਚਿਆਂ ਨੂੰ ਹਾਂ ਬਿਲਕੁਲ ਹਾਂ ਜਿਵੇਂ ਆਪਾਂ ਵਿੱਚ ਆਪਣੀ ਰਿਸੈਸ ਦਾ ਟਾਈਮ ਕਵਰ ਕਰ ਲਵਾਂਗੇ ਜਾਂ ਕੁਛ ਵੀ ਹੈ ਨਾ ਇਹ ਕਰ ਸਕਦੇ ਹੈਂਗੇ ਵੀ ਅਸੀਂ ਟਾਈਮ ਘੱਟ ਲਗਾ ਲਵਾਂਗੇ ਹਾਂ ਬਾਕੀ

ਬਿਲਕੁਲ ਬਾਕੀ ਮੈਡਮ ਇਹ ਦੋ ਸਬਜੈਕਟ ਦਾ ਤਾਂ ਆਪਣਾ ਸਿਲੇਬਸ ਤਕਰੀਬਨ ਕੰਪਲੀਟ ਹੀ ਹੈ ਜਿਨ੍ਹਾਂ ਦਾ ਰਹਿੰਦਾ ਆਪਾਂ ਉਹ ਮੇਨ ਪੀਰੀਅਡ ਲੈ ਲਿਆ ਕਰਾਂਗੇ ਬੱਚਿਆਂ ਦੇ ਹੈ ਨਾ ਵੀ ਆਪਾਂ ਨੂੰ ਤਾਂ ਐਂ ਆਂ ਵੀ ਬੱਚੇ ਕਰ ਲੈਣ ਹਾਂ ਤੁਸੀਂ ਆਪਣੇ ਬਿਹਾਫ 'ਤੇ ਕਰੋ ਐਕਚੁਲੀ ਮੈਡਮ ਨਾਲ ਜਿਵੇਂ ਕਹਿਣਗੇ ਮੈਨੂੰ ਉਵੇਂ ਠੀਕ ਹੈ ਆਪਾਂ ਤਾਂ ਬੱਚਿਆਂ 'ਤੇ ਹਾਂ ਹਾਂ ਬੱਚਿਆਂ ਨਾਲ ਜਿਵੇਂ ਤੁਸੀਂ ਕਹੂੰਗੇ ਫੋਨ 'ਤੇ ਗੱਲ ਕਰਨੀ ਹੈ ਅੱਧੇ ਬੱਚਿਆਂ ਨਾਲ ਤੁਸੀਂ ਕਰ ਲਿਓ ਅੱਧਿਆਂ ਨਾਲ ਮੈਂ ਕਰ ਲੂ ਜਾਣਾ ਪਿਆ ਜਾਣ ਦੀ ਵੀ ਆਪਾਂ ਨੂੰ ਹਾਂ ਕੋਈ ਦਿੱਕਤ ਨਹੀਂ ਹੈਗੀ ਜਿਵੇਂ ਕੱਲ ਨੂੰ ਜਾਂ ਪਰਸੋਂ ਮੌਸਮ ਵਧੀਆ ਹੋਇਆ ਆਪਾਂ ਜਿਹੜੇ ਬੱਚਿਆਂ ਨੂੰ ਲੱਗਦਾ ਫੋਨ 'ਤੇ ਨਹੀਂ ਪੇਰੈਂਟਸ ਆਪਾਂ ਨੂੰ ਮਿਲਣਗੇ ਆਪਾਂ ਜਾ ਵੀ ਆਵਾਂਗੇ ਕੋਈ ਦਿੱਕਤ ਨਹੀਂ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਮਸਲਾ ਹੈ ਨਾ ਆਪਾਂ ਨੂੰ ਤਾਂ ਐਂ ਹੈ ਕਿ ਸਿਲੇਬਸ ਕਵਰ ਹੋ ਕੇ ਆਪਣੇ ਬੱਚਿਆਂ ਦਾ ਰਿਜਲਟ ਵਧੀਆ ਆਵੇ ਆਪਾਂ ਰਿਵੀਜਨ ਕਰਵਾ ਸਕੀਏ ਬੱਚਿਆਂ ਨੂੰ ਹਾਂ ਬਿਲਕੁਲ ਮੈਡਮ ਫਿਰ ਤੁਸੀਂ ਮੈਨੂੰ ਦੱਸਿਓ ਜਿਵੇਂ ਕਹਿਣਗੇ ਆਪਾਂ ਉਵੇਂ ਕਰ ਲਵਾਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮੈਡਮ ਥੈਂਕ ਯੂ ਜੀ ਓਕੇ ਜੀ ਓਕੇ